ਪੰਜ ਜੁਲਾਈ ਉੱਨੀ ਸੌ ਚੌਦਾਂ ਅਠਾਰਾਂ ਜਨਵਰੀ ਉੱਨੀ ਸੌ ਅਠਾਰਾਂ ਤੀਹ ਨਵੰਬਰ ਉੱਨੀ ਸੌ ਅੱਸੀ ਇੱਕ ਮਾਰਚ ਉੱਨੀ ਸੌ ਪਚਾਸੀ ਦੋ ਜੂਨ ਉੱਨੀ ਸੌ ਨੱਬੇ